ਪੇਂਟਿੰਗ ਲਈ ਸਭ ਤੋਂ ਪਹਿਲਾਂ ਤਾਂ ਸਾਨੂੰ ਇੱਕ ਬ੍ਰਸ਼ ਅਤੇ ਕਲਰਸ ਦੀ ਜ਼ਰੂਰਤ ਪੈਂਦੀ ਹੈ ਅਤੇ ਇੱਕ ਖਾਲੀ ਚਿੱਟੇ ਪੇਜ ਦੀ ਜ਼ਰੂਰਤ ਪੈਂਦੀ ਹੈ ਚਿੱਟਾ ਪੇਜ ਥੋੜ੍ਹਾ ਮੋਟਾ ਹੋਣਾ ਚਾਹੀਦਾ ਹੈ ਕਿਉਂਕਿ ਕਲਰ ਕਰਨ ਲਈ ਪਾਣੀ ਦੀ ਵੀ ਜ਼ਰੂਰਤ ਪੈਂਦੀ ਹੈ ਜਿਸ ਕਾਰਣ ਪੇਜ ਫਟ ਸਕਦਾ ਹੈ ਇਸ ਲਈ ਸਾਨੂੰ ਮੋਟੇ ਪੇਜ ਦੀ ਵਰਤੋਂ ਹੀ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਫਿਰ ਬ੍ਰਸ਼ ਨੂੰ ਹੱਥ 'ਚ ਫੜ ਕੇ ਪੇਜ 'ਤੇ ਪੇਂਟਿੰਗ ਕੀਤੀ ਜਾਂਦੀ ਹੈ ਅਤੇ ਕਲਰਸ ਨੂੰ ਅਲੱਗ ਅਲੱਗ ਅੱਖਰਾਂ ਨੂੰ ਬ੍ਰਸ਼ ਨਾਲ ਅਤੇ ਪੇਂਟ ਨਾਲ ਲਿਖਿਆ ਜਾਂਦਾ ਹੈ ਕਲਰਸ ਨਾਲ ਆਪਾਂ ਅਲੱਗ ਅਲੱਗ ਅੱਖਰਾਂ ਨੂੰ ਪੇਜ ਉੱਤੇ ਲਿਖਦੇ ਹਾਂ ਅਤੇ ਇਸ ਤਰ੍ਹਾ ਫਲਾਵਰਸ ਹੱਟ ਟ੍ਰੀ ਅਤੇ ਬਹੁਤ ਸਾਰੀਆਂ ਚੀਜ਼ਾਂ ਬਣਦੀਆਂ ਹਨ ਪੇਂਟਿੰਗ ਨਾਲ ਆਪਾਂ ਬਹੁਤ ਸਾਰੀਆਂ ਚੀਜ਼ਾਂ ਬਣਾ ਸਕਦੇ ਹਾਂ ਇਸ ਤਰ੍ਹਾ ਸਕੂਲ ਵਿੱਚ ਸਾਨੂੰ ਹੱਟ ਟ੍ਰੀ ਅਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਬਣਾਉਣੀਆਂ ਸਿਖਾਈਆਂ ਹਨ ਧੰਨਵਾਦ